ਮੈਂ ਕਪੂਰਥਲਾ ਸ਼ਹਿਰ ਦੀ ਰਹਿਣ ਵਾਲੀ ਹਾਂ ਅਤੇ ਮੈਂ ਇਹ ਚਾਹੁੰਦੀ ਹਾਂ ਕਿ ਸਾਡੇ ਸ਼ਹਿਰ ਨੂੰ ਬਹੁਤ ਹੀ ਸੋਹਣਾ ਸਾਫ਼ ਸੁਥਰਾ ਅਤੇ ਤਰੱਕੀ ਵਾਲਾ ਸ਼ਹਿਰ ਬਣਾ ਦਿੱਤਾ ਜਾਵੇ ਮੈਂ ਇਹ ਸਰਕਾਰ ਦੇ ਅੱਗੇ ਬੇਨਤੀ ਕਰਨਾ ਚਾਹੁੰਦੀ ਹਾਂ ਕਿ ਸਾਡੇ ਸ਼ਹਿਰ ਦੇ ਵਿੱਚ ਸਿਹਤ ਸੰਭਾਲ ਦੇ ਵੱਲ ਵੀ ਧਿਆਨ ਦਿੱਤਾ ਜਾਵੇ ਸਾਡੇ ਸ਼ਹਿਰ ਦੇ ਵਿੱਚ ਹੋਰ ਕਈ ਆਧੁਨਿਕ ਤਕਨੀਕਾਂ ਵਾਲੇ ਹਸਪਤਾਲ ਖੋਲ੍ਹੇ ਜਾਣ ਜਿੱਥੇ ਕਿ ਮਰੀਜਾਂ ਦੀ ਗੰਭੀਰ ਤੋਂ ਗੰਭੀਰ ਬਿਮਾਰੀਆਂ ਦਾ ਇਲਾਜ ਹੋ ਸਕੇ ਅਤੇ ਸਾਡੇ ਆਵਾਜਾਈ ਅਤੇ ਹੋਰ ਸਿੱਖਿਆ ਅਤੇ ਹੋਰ ਅਤੇ ਕਈ ਬੁਨਿਆਦੀ ਲੋੜਾਂ ਨੂੰ ਵੀ ਪੂਰੀਆਂ ਕਰਨ ਦੀ ਸਰਕਾਰ ਤੋਂ ਮਦਦ ਦੀ ਉਮੀਦ ਕਰਦੀ ਹਾਂ ਸਾਡੇ ਸ਼ਹਿਰ ਦੇ ਵਿੱਚ ਇੱਕੋ ਹੀ ਛੋਟਾ ਜਿਹਾ ਬੱਸ ਸਟੈਂਡ ਹੈ ਮੈਂ ਸਰਤਾ ਸਰਕਾਰ ਕੋਲੋਂ ਇਹ ਦਰਖ਼ਾਸਤ ਕਰਨਾ ਚਾਹੁੰਦੀ ਹਾਂ ਕਿ ਸਾਡੇ ਸ਼ਹਿਰ ਦੇ ਵਿੱਚ ਇੱਕ ਹੋਰ ਥੋੜ੍ਹਾ ਵੱਡਾ ਬੱਸ ਸਟੈਂਡ ਜਾਂ ਉਸ ਬੱਸ ਸਟੈਂਡ ਨੂੰ ਵੱਡਾ ਕਰ ਦਿੱਤਾ ਜਾਵੇ ਤਾਂ ਕਿ ਹੋਰ ਕਈ ਸ਼ਹਿਰਾਂ ਕਈ ਕਈ ਵੱਖ ਵੱਖ ਦੂਰ ਦੁਰਾਡੇ ਦੇ ਇਲਾਕਿਆਂ ਦੇ ਵਿੱਚ ਵੀ ਉੱਥੋਂ ਬੱਸਾਂ ਆਉਣ ਜਾ ਸਕਣ ਤਾਂ ਕਿ ਸਾਡੇ ਸ਼ਹਿਰ ਦੇ ਲੋਕਾਂ ਨੂੰ ਆਵਾਜਾਈ ਦੀ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਸਾਡੇ ਸ਼ਹਿਰ ਦੇ ਵਿੱਚ ਉਂਝ ਤਾਂ ਬਹੁਤ ਹੀ ਚੰਗੇ ਸਕੂਲ ਕਾਲਜ ਹਨ ਪਰ ਮੈਂ ਸਰਕਾਰ ਕੋਲੋਂ ਇਹ ਮਦਦ ਚਾਹੁੰਦੀ ਹਾਂ ਕਿ ਸਾਡੇ ਸਕੂਲਾਂ ਕਾਲਜਾਂ ਦੇ ਵਿੱਚ ਕੰਪਿਊਟਰਾਂ ਨੂੰ ਅਤੇ ਹੋਰ ਕਈ ਆਧੁਨਿਕ ਤਕਨੀਕਾਂ ਦੇ ਰਾਹੀਂ ਉਨ੍ਹਾਂ ਦੇ ਅੰਦਰ ਕਈ ਇਹੋ ਜਿਹੇ ਵਿਕਾਸ ਕੀਤੇ ਜਾਣ ਜਿੱਥੇ ਕਿ ਸਾਡੇ ਸ਼ਹਿਰ ਦੇ ਬੱਚਿਆਂ ਨੂੰ ਹੋਰ ਕਿਤੇ ਪੜ੍ਹਨ ਜਾਣ ਦੀ ਲੋੜ ਨਾ ਪਵੇ ਅਤੇ ਹੋਰ ਕਈ ਬੁਨਿਆਦੀ ਲੋੜਾਂ ਜਿਵੇਂ ਬਿਜਲੀ ਪਾਣੀ ਸਾਫ਼ ਸਫਾਈ ਆਦਿ ਦੀ ਵੀ ਮਦਦ ਕੀਤੀ ਜਾਵੇ ਧੰਨਵਾਦ